ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਬਹੁਤ ਪਹਿਲੇ ਤੋਂ ਹੀ ਸੱਭਿਆਚਾਰ ਅਤੇ ਸਮਾਜ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੋਈ ਹੈ ਸਾਡੇ ਪੰਜਾਬ ਵਿਚ ਇੱਕ ਐਨਾ ਉਤਸ਼ਾਹ ਹੈਗਾ ਹਰ ਚੀਜ਼ ਨੂੰ ਕਰਨ ਦਾ ਹਰ ਕਲਾ 'ਚ ਹਰ ਹਰ ਸ਼ਿਲਪਕਾਰੀ ਦੇ ਵਿੱਚ ਐਨਾ ਕੁ ਉਤਸ਼ਾਹ ਹੈ ਕਿ ਕੋਈ ਵੀ ਜਣਾ ਇੱਥੇ ਆ ਕੇ ਇਹਨਾਂ ਦੇ ਕੰਮ ਤੋਂ ਦੂਰ ਨਹੀਂ ਭੱਜ ਸਕਦਾ ਸਭ ਨੂੰ ਹੁੰਦਾ ਕਿ ਅਸੀਂ ਵੀ ਇੱਦਾਂ ਦੀ ਕਲਾ ਕਰੀਏ ਸ਼ਿਲਪਕਾਰੀ ਕਰੀਏ ਕਿ ਜਿੱਦਾਂ ਸਾਡਾ ਦੇਸ਼ ਅੱਗੇ ਵਧੇ